ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਉਹ ਚਲੋ ਮੈਂ ਨਾ ਤੁਹਾਨੂੰ ਫੋਨ ਕੀਤਾ ਸੀਗਾ ਮੇਰੇ ਨਾ ਸਕੂਲ ਦੇ ਵਿੱਚ ਨਾ ਇੱਕ ਮਤਲਬ ਪ੍ਰੋਜੈਕਟ ਮਿਲਿਆ ਸਾਨੂੰ ਮਤਲਬ ਉਸ ਟਾਈਮ ਦੇ ਵਿੱਚ ਕੀ ਕੁਛ ਹੋਇਆ ਸੀ ਮੈਂ ਕਿਹਾ ਲੈ ਤੁਹਾਡੇ ਤੋਂ ਵਧੀਆ ਕਿਹਨੇ ਮੈਨੂੰ ਦੱਸਣਾ ਹੈਨਾ ਅਤੇ ਉਹ 'ਚ ਮੈਨੂੰ ਦੱਸੋਗੇ ਵੀ ਉਦੋਂ ਕੀ ਕੁਛ ਹੋਇਆ ਸੀ ਤੁਸੀਂ ਸਾਰਾ ਕੁਛ ਦੇਖਿਆ ਵੀ ਜਦੋਂ ਵੰਡ ਵੇਲੇ ਕੀ ਹੋਇਆ ਜੋ ਸਾਡੇ ਫਰੀਡਮ ਫਾਈਟਰ ਨੇ ਕੀ ਕੀਤਾ ਉਸ ਟਾਈਮ 'ਤੇ ਹੈਨਾ ਕੀ ਕੁਛ ਹੁੰਦਾ ਸੀ ਤੇ ਦੱਸੋ ਤਾਂ ਮੈਨੂੰ ਜਰਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਤੁਸੀਂ ਮਤਲਬ ਅੱਛਾ ਓ ਹੋ ਅੱਛਾ ਤੁਸੀਂ ਸਾ ਤੁਸੀਂ ਦੇਖਿਆ ਸਾਰਾ ਕੁਛ ਤੁਹਾਨੂੰ ਉਸ ਟਾਈਮ ਦੀ ਕੋਈ ਹੋਸ਼ ਹੈਗੀ ਵੀ ਮਤਲਬ ਤੁਸੀਂ ਕਿੰਨੇ ਕੁ ਸਾਲ ਦੇ ਸੀ ਉਦੋਂ ਅੱਛਾ

ਅੱਛਾ ਓ ਹੋ ਅੱਛਾ ਅੱਛਾ ਅੱਛਾ ਅੱਛਾ ਅੱਛਾ ਹਾਂ ਨਹੀਂ ਠੀਕ ਆ ਅੱਛਾ ਅੱਛਾ ਹਾਂ ਮਤਲਬ ਉਹਨਾਂ ਸਮਿਆਂ 'ਚ ਵੀ ਲੋਕਾਂ 'ਚ ਪਿਆਰ ਜ਼ਿਆਦਾ ਸੀ ਨਾ ਅੱਛਾ ਠੀਕ ਹੈ ਠੀਕ ਹੈ ਹੋਰ ਹੋਰ ਕੋਈ ਕੋਈ ਖ਼ਾਸ ਗੱਲ ਉਸ ਟਾਈਮ ਦੀ ਠੀਕ ਹੈ ਠੀਕ ਹੈ ਚਲੋ ਕੋਈ ਨਹੀਂ ਚਲੋ ਠੀਕ ਹੈ ਦਾਰ ਜੀ ਤੁਸੀਂ ਵਧੀਆ ਮੈਨੂੰ ਦੱਸ ਦਿੱਤਾ ਮੈਂ ਹੁਣ ਆਪਣਾ ਸਾਰਾ ਲਿਖ ਸਕਦੀ ਹੈ ਟੋਪਿਕ 'ਤੇ ਹੈਨਾ ਅਤੇ ਬਾਕੀ ਆਪਾਂ ਜਲਦੀ ਮਿਲਾਂਗੇ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖੋ ਓਕੇ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ